ਸੈਲਫ ਹੈਲਪ ਗਰੁੱਪ ਇੱਕ ਅਜਿਹਾ ਗਰੁੱਪ ਹੈ ਜਿਹੜਾ ਕਿ ਔਰਤਾਂ ਦੀ ਮਦਦ ਲਈ ਬਣਿਆ ਹੈ ਇਹ ਗਰੁੱਪ ਔਰਤਾਂ ਨੂੰ ਰੁਜ਼ਗਾਰ ਕਮਾਉਣ ਦੇ ਤਰੀਕਿਆਂ ਬਾਰੇ ਦੱਸਦਾ ਹੈ ਕਿ ਔਰਤ ਕਿਸੇ ਨਾਲੋਂ ਘੱਟ ਨਹੀਂ ਹੈ ਉਹ ਖੁਦ ਰੁਜ਼ਗਾਰ ਕਮਾ ਸਕਦੀ ਹੈ ਉਸਨੂੰ ਕਿਸੇ 'ਤੇ ਡਿਪੈਂਡ ਹੋਣ ਦੀ ਜ਼ਰੂਰਤ ਨਹੀਂ ਹੈ ਜਿਵੇਂ ਕਿ ਇੱਕ ਔਰਤ ਹੋਣ ਦੇ ਨਾਤੇ ਮੈਨੂੰ ਪਤਾ ਹੈ ਕਿ ਇੱਕ ਔਰਤ ਦੇ ਲਈ ਰੁਜ਼ਗਾਰ ਕਿੰਨਾ ਜ਼ਰੂਰੀ ਹੈ ਇਹ ਗਰੁੱਪ ਔਰਤਾਂ ਨੂੰ ਜਿਵੇਂ ਕਿ ਸਿਲਾਈ ਕਢਾਈ ਅਤੇ ਹੋਰ ਕੰਮਾਂ ਦੇ ਬਾਰੇ ਦੱਸਦਾ ਹੈ ਬਹੁਤ ਅਜਿਹੇ ਕੰਮ ਹਨ ਜਿਹੜੇ ਕਿ ਔਰਤ ਕਰ ਸਕਦੀ ਹੈ ਅਤੇ ਖੁਦ ਰੁਜ਼ਗਾਰ ਕਮਾ ਕੇ ਆਪਣੇ ਪੈਰਾਂ 'ਤੇ ਸਟੈਂਡ ਕਰ ਸਕਦੀ ਹੈ ਇੱਕ ਔਰਤ ਦੇ ਲਈ ਰੁਜ਼ਗਾਰ ਕਿੰਨਾ ਜ਼ਰੂਰੀ ਹੁੰਦਾ ਹੈ ਕਿ ਉਹ ਆਪਣੇ ਰੁਜ਼ਗਾਰ ਦੇ ਨਾਲ ਉਸਨੂੰ ਅੱਗੇ ਵਧੇ ਅਤੇ ਆਪਣਾ ਵਿਕਾਸ ਕਰੇ